ਅਸੀਂ ਲੰਬੀ ਬਾਈਕਿੰਗ ਯਾਤਰਾ ਦੇ ਟੂਰ ਲਈ ਕੁਝ ਇਸ ਤਰ੍ਹਾਂ ਤਿਆਰ ਹੋ ਕੇ ਜਾਵਾਂਗੇ ਸਭ ਤੋਂ ਪਹਿਲਾਂ ਅਸੀਂ ਆਪਣੀ ਬਾਈਕਿੰਗ ਯਾਤਰਾ ਆਪਣੀ ਮਨਪਸੰਦ ਬਾਈਕ 'ਤੇ ਲੈ ਕੇ ਜਾਵਾਂਗੇ ਮੈਂ ਕੁਝ ਆਪਣੇ ਦੋਸਤਾਂ ਨਾਲ ਮਨਪਸੰਦ ਦੋਸਤਾਂ ਨਾਲ ਜਾਣਾ ਚਾਹੁੰਦਾ ਹਾਂ ਜਿਵੇਂ ਕਿ ਮੈਨੂੰ ਬਰਫ ਵਿੱਚ ਜਿਵੇਂ ਲੇਹ ਲਦਾਖ ਜਾਣਾ ਪਸੰਦ ਕਰਦਾ ਹਾਂ ਉੱਥੇ ਦਾ ਮੌਸਮ ਬਹੁਤ ਹੀ ਠੰਡਾ ਅਤੇ ਸੁਹਾਵਣਾ ਹੁੰਦਾ ਹੈ ਉੱਥੋਂ ਮਹੱਤਵਪੂਰਨ ਗਰਮ ਜਿਵੇਂ ਆਪਣੇ ਨਾਲ ਗਰਮ ਕੱਪੜੇ ਬੂਟ ਅਤੇ ਸਿਹਤ ਲਈ ਸੰਬੰਧਿਤ ਦਵਾਈਆਂ ਘਰ ਤੋਂ ਕੁਝ ਹੋਰ ਖਾਣ ਪੀਣ ਦਾ ਸਮਾਨ ਲੈ ਕੇ ਜਾਣਾ ਪਸੰਦ ਕਰਾਂਗਾ